ਭੰਗੜਾ ਪੰਜਾਬ ਦਾ ਮੁੱਖ ਨਾਚ ਹੈ ਭੰਗੜਾ ਭੰਗੜੇ ਦੇ ਕੁਛ ਆਮ ਸਟੈਪ ਹਨ ਜਿਵੇਂ ਝੂੰਮਰ ਲੁੱਡੀ ਧਮਾਲ ਭੰਗੜਾ ਸਾਡੇ ਪੰਜਾਬ ਦਾ ਇੱਕ ਬਹੁਤ ਵਧੀਆ ਲੋਕ ਲਾਚ ਹੈ ਇਸ ਨੂੰ ਪੰਜਾਬੀ ਭਰਾ ਬਹੁਤ ਪਸੰਦ ਕਰਦੇ ਹਨ ਭੰਗੜਾ ਸਾਡੇ ਹਰੇਕ ਖੁਸ਼ ਪੰਜਾਬ ਦੇ ਵਿੱਚ ਹਰੇਕ ਖੁਸ਼ੀ ਪੰਜਾਬ ਦੇ ਵਿੱਚ ਹਰੇਕ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਅਤੇ ਭੰਗੜਾ ਸਾਡੇ ਪੰਜਾਬ ਵਿੱਚ ਲੋਹੜੀ ਦੇ ਤਿਉਹਾਰ ਵਾਲੇ ਦਿਨ ਲੋਕ ਸਾਰੇ ਸਾਡੇ ਪੰਜਾਬੀ ਭਰਾ ਭੈਣ ਸਾਰੇ ਇਕੱਠੇ ਹੋ ਕੇ ਗਲੀ ਵਿੱਚ ਅੱਗ ਬਾਲਦੇ ਹਨ ਅਤੇ ਉਸ ਅੱਗ ਦੇ ਆਲੇ ਦੁਆਲੇ ਭੰਗੜਾ ਪਾਉਂਦੇ ਹਨ ਸਰ ਭੰਗੜਾ ਪੰਜਾਬ ਵਿੱਚ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰ ਹੋਰ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਸਾਡੇ ਪੰਜਾਬੀ ਭਰਾ ਵੱਸਦੇ ਹਨ ਉੱਥੇ ਉਹਨਾਂ ਨੇ ਭੰਗੜਾ ਮਸ਼ਹੂਰ ਕਰ ਦਿੱਤਾ ਹੈ ਸਾਡੇ ਪੰਜਾਬ ਦੇ ਵਿੱਚ ਭੰਗੜਾ ਸਾਡੇ ਪੰਜਾਬ ਦੇ ਸਰਕਾਰੀ ਸਕੂਲਾਂ ਕਾਲਜਾਂ ਜਾਂ ਹੋਰ ਯੂਨੀਵਰਸਿਟੀਆਂ ਵਿੱਚ ਭੰਗੜਿਆਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਪੰਜਾਬ ਦੇ ਵਿੱਚ ਭੰਗੜਿਆਂ ਦੀ ਵੱਡੀਆਂ ਵੱਡੀਆਂ ਅਕੈਡਮੀਆਂ ਖੋਲੀਆਂ ਗਈਆਂ ਹਨ ਜਿੱਥੇ ਛੋਟੇ ਛੋਟੇ ਵੱਡੇ ਬੱਚਿਆਂ ਨੂੰ ਭੰਗੜਾ ਸਿਖਾਇਆ ਜਾਂਦਾ ਹੈ ਅਤੇ ਭੰਗੜਾ ਦੇ ਸਟੈਪ ਸਿਖਾਏ ਜਾਂਦੇ ਹਨ ਭੰਗੜਾ ਸਾਡੇ ਪੰਜਾਬ ਦੀ ਜਾਨ ਹੈ ਸ਼ਾਨ ਹੈ ਮਾਨ ਹੈ ਅਤੇ ਭੰਗੜਾ ਸਾਡੇ ਲਈ ਬਹੁਤ ਜ਼ਰੂਰੀ ਹੈ ਭੰਗੜਾ ਪਾਉਣ ਨਾਲ ਭੰ ਬੋਡੀ ਫਿਟ ਰਹਿੰਦੀ ਹੈ ਭੰਗੜਾ ਜਿੰਨੇ ਉਤਸਾਹ ਨਾਲ ਮਨਾਇਆ ਜਾਵੇ ਉਨਾ ਹੀ ਵਧੀਆ ਲੱਗਦਾ ਹੈ